ਪੜ੍ਹਨ ਦੇ ਨਾਲ ਨਾਲ ਸਾਨੂੰ ਖੇਡਣਾ ਵੀ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹੈ ਮੈਂ ਬਹੁਤ ਸਾਰੀ ਗੇਮਾਂ ਖੇਡਦਾ ਹਾਂ ਜਿਹਦੇ ਵਿੱਚ ਅੰਦਰੂਨੀ ਗੇਮਾਂ ਅਤੇ ਬਾਹਰਲੀ ਗੇਮਾਂ ਵੀ ਆਉਂਦੀਆਂ ਹਨ ਮੈਨੂੰ ਜ਼ਿਆਦਾਤਰ ਬਾਹਰਲੇ ਵਾਲੀਆਂ ਗੇਮਾਂ ਖੇਡਣ ਦਾ ਜ਼ਿਆਦਾ ਮਜ਼ਾ ਆਉਂਦਾ ਹੈ ਜਿਹਦੇ ਵਿੱਚ ਕ੍ਰਿਕਟ ਇੱਕ ਐਸੀ ਖੇਡ ਹੈ ਜਿਹੜੀ ਮੈਂ ਲਗਭਗ ਰੋਜ਼ ਹੀ ਖੇਲਦਾ ਹਾਂ ਮੈਂ ਕ੍ਰਿਕਟ ਆਪਣੇ ਆਂਢ ਗੁਆਂਢ ਦੇ ਭਰਾਵਾਂ ਨਾਲ ਅਤੇ ਆਪਣੇ ਦੋਸਤਾਂ ਨਾਲ ਖੇਡਣਾ ਹੀ ਪਸੰਦ ਕਰਦਾ ਹਾਂ ਉਹਨਾਂ ਨਾਲ ਖੇਡਣ ਦਾ ਮਜ਼ਾ ਹੀ ਅਲੱਗ ਹੈ ਅਸੀਂ ਕ੍ਰਿਕਟ ਆਪਣੀ ਪਿੰਡ ਦੇ ਛੋਟੇ ਜਿਹੇ ਗਰਾਊਂਡ ਵਿੱਚ ਖੇਡਦੇ ਹਾਂ ਸਾਨੂੰ ਕ੍ਰਿਕਟ ਖੇਡਣਾ ਚਾਹੀਦਾ ਹੈ ਕਿਉਂਕਿ ਕ੍ਰਿਕਟ ਸਾਡੀ ਜ਼ਿੰਦਗੀ ਨੂੰ ਸਾਡੇ ਵਿੱਚ ਹਰ ਤਰ੍ਹਾਂ ਦੀ ਭਾਵਨਾ ਇੱਕ ਉਕਰਜਿਤ ਕਰਦਾ ਹੈ ਕ੍ਰਿਕਟ ਖੇਡਣ ਨਾਲ ਸਾਡੇ ਵਿੱਚ ਭਾਈਚਾਰੇ ਦੀ ਭਾਵਨਾ ਵੀ ਆਉਂਦੀ ਹੈ ਕਿਉਂਕਿ ਸਾਨੂੰ ਪੂਰੀ ਟੀਮ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ ਕ੍ਰਿਕਟ ਖੇਡਣ ਨਾਲ ਸਾਡਾ ਪੂਰਾ ਆਲਸ ਦੂਰ ਹੋ ਜਾਂਦਾ ਹੈ ਕਿਉਂਕਿ ਅਸੀਂ ਹਰ ਹਰ ਪਾਸੋਂ ਸਾਨੂੰ ਚੁਕੰਨਾ ਰਹਿਣਾ ਪੈਂਦਾ ਹੈ ਕਿਉਂਕਿ ਕਿਤੋਂ ਵੀ ਬੋਲ ਆ ਸਕਦੀ ਹੈ ਸਾਨੂੰ ਕੈਚ ਫੜਨਾ ਪਏਗਾ ਅਤੇ ਬੈਟਿੰਗ ਵਿੱਚ ਤਾਂ ਨਜ਼ਾਰਾ ਹੀ ਅਲੱਗ ਹੈ ਬੈਟਿੰਗ ਕਰਨ ਦੇ ਵਕਤ ਸਾਨੂੰ ਹਮੇਸ਼ਾਂ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੇ ਲਈ ਨਹੀਂ ਆਪਣੀ ਟੀਮ ਲਈ ਖੇਡਣਾ ਹੈ ਅਤੇ ਟੀਮ ਲਈ ਕੁਛ ਕਰਕੇ ਵਿਖਾਣਾ ਹੈ ਕ੍ਰਿਕਟ ਖੇਡਣ ਦੇ ਬਹੁਤ ਸਾਰੇ ਲਾਭ ਹਨ ਜਿਹਨਾਂ ਵਿੱਚੋਂ ਕੁਛ ਮੈਂ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਹਾਂ ਕ੍ਰਿਕਟ ਖੇਡਣ ਨਾਲ ਸਾਡਾ ਮਾਨਸਿਕ ਅਤੇ ਸਰੀਰਿਕ ਸੰਤੁਲਨ ਰਹਿੰਦਾ ਹੈ ਕ੍ਰਿਕਟ ਖੇਡਣ ਨਾਲ ਸਾਨੂੰ ਆਲਸ ਦਾ ਤਿਆਗ ਹੁੰਦਾ ਹੈ ਕ੍ਰਿਕਟ ਖੇਡਣ ਨਾਲ ਅਸੀਂ ਬਹੁਤ ਸ ਜ਼ਿਆਦਾ ਮਿਹਨਤੀ ਹੋ ਜਾਂਦੇ ਹਨ ਅਤੇ ਸਬਰ ਦਾ ਫਲ ਵੀ ਲੈਣਾ ਸਿੱਖ ਜਾਂਦੇ ਹਾਂ ਕਿਉਂਕਿ ਕ੍ਰਿਕਟ ਵਿੱਚ ਕਈ ਵਾਰ ਤੁਹਾਡੀ ਟਰਨ ਨਹੀਂ ਵੀ ਆਉਂਦੀ ਤਾਂ ਵੀ ਤੁਸੀਂ ਆਪਣੀ ਟਰਨ ਦਾ ਵੇਟ ਕਰਦੇ ਹੋ ਅਤੇ ਕ੍ਰਿਕਟ ਨਾਲ ਸਾਨੂੰ ਹਾਰਨ ਜਾਂ ਜਿੱਤਣ ਦਾ ਕੋਈ ਗਮ ਨਹੀਂ ਹੁੰਦਾ ਅਸੀਂ ਖੇਡਦੇ ਹਾਂ ਅਤੇ ਆਰਾਮ ਨਾਲ ਹਰ ਇੱਕ ਕੰਮ ਕਰਦੇ ਹਾਂ ਸਾਨੂੰ ਭਾਈਚਾਰੇ ਦੀ ਭਾਵਨਾ ਤੋਂ ਲੈ ਕੇ ਦੋਸਤੀ ਦੀ ਭਾਵਨਾ ਵੀ ਕ੍ਰਿਕਟ ਨਾਲ ਰਹਿੰਦੀ ਹੈ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਕ੍ਰਿਕਟ ਖੇਡਣਾ ਚਾਹੀਦਾ ਹੈ ਕਈ ਲੋਕਾਂ ਲਈ ਖੇਡਣਾ ਬਹੁਤ ਸਹੀ ਹੈ ਕਿਉਂਕਿ ਅੱਜ ਕੱਲ੍ਹ ਦੇ ਯੁੱਗ ਵਿੱਚ ਲੋਕ ਫੋਨਾਂ ਵਿੱਚ ਰੁੱਝੇ ਹਨ ਲੇਕਿਨ ਸਾਨੂੰ ਫੋਨਾਂ ਨੂੰ ਛੱਡ ਕੇ ਬਾਹਰਲੀ ਦੁਨੀਆਂ ਵਿੱਚ ਰਹਿਣਾ ਚਾਹੀਦਾ ਹੈ ਅਤੇ ਵੱਖ ਵੱਖ ਗੇਮਾਂ ਖੇਡਣੀਆਂ ਚਾਹੀਦੀਆਂ ਹਨ ਧੰਨਵਾਦ